ਭਾਰਤ ਵਿੱਚ ਇੱਕ ਮਿਲਿਆ ਜੁਲਿਆ ਮੌਸਮ ਰਹਿੰਦਾ ਹੈ ਕਿਉਂਕਿ ਭਾਰਤ ਦਾ ਖੇਤਰਫਲ ਜ਼ਿਆਦਾ ਹੋਣ ਕਰਕੇ ਇਹਦੇ ਵੱਖ ਵੱਖ ਸੂਬਿਆਂ ਵਿੱਚ ਇਹ ਮਤਲਬ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਦਾ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਕਾਫ਼ੀ ਠੰਡਾ ਰਹਿੰਦਾ ਹੈ ਅਤੇ ਕਈ ਸੂਬਿਆਂ ਵਿੱਚ ਕਾਫ਼ੀ ਗਰਮੀ ਪੈਂਦੀ ਹੈ ਮੁੱਖ ਤੌਰ 'ਤੇ ਭਾਰਤ ਵਿੱਚ ਗਰਮੀ ਬਰਸਾਤ ਦੀ ਰੁੱਤ ਸਰਦੀ ਪਤਝੜ ਅਤੇ ਬਸੰਤ ਰੁੱਤ ਆਉਂਦੀ ਹੈ ਬਰਸਾਤਾਂ ਵਿੱਚ ਵੀ ਦੇਸ਼ ਦੇ ਕਈ ਕੋਨਿਆਂ ਵਿੱਚ ਕਾਫ਼ੀ ਮਾਤਰਾ ਵਿੱਚ ਬਰਸਾਤ ਹੋ ਜਾਣ ਵਜੋਂ ਹੜਾਂ ਵਰਗੀ ਸਥਿੱਤੀ ਪੈਦਾ ਹੋ ਜਾਂਦੀ ਹੈ ਇਸ ਤੋਂ ਇਲਾਵਾ ਦੇਸ਼ ਦੇ ਕਈ ਸੂਬੇ ਸੋਕੇ ਦੀ ਮਾਰ ਝੱਲਦੇ ਹਨ ਜਿਸ ਕਰਕੇ ਉੱਥੋਂ ਦੇ ਖੇਤੀਬਾੜੀ ਵੀ ਕਾਫ਼ੀ ਪ੍ਰਭਾਵਿਤ ਹੁੰਦੀ ਹੈ ਇਸ ਲਈ ਅਸੀਂ ਭਾਰਤ ਨੂੰ ਕਿਸੇ ਇੱਕ ਤਰ੍ਹਾਂ ਦੇ ਮੌਸਮ ਦਾ ਜਿਕਰ ਨਹੀਂ ਕਰ ਸਕਦੇ ਵੀ ਇੱਥੇ ਸਿਰਫ਼ ਇੱਕ ਤਰ੍ਹਾਂ ਦਾ ਹੀ ਮੌਸਮ ਰਹਿੰਦਾ ਹੈ ਕਿਉਂਕਿ ਭਾਰਤ ਵਿੱਚ ਜਿਸ ਤਰ੍ਹਾਂ ਆਪਾਂ ਕਹਿ ਦੇਈਦਾ ਹੈ ਵਨ ਸਵੰਨਤਾ ਬੋਲੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਵਿੱਚ ਹੈ ਇਸ ਤਰ੍ਹਾਂ ਹੀ ਮੌਸਮ ਵਿੱਚ ਵਨ ਸਵੰਨਤਾ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਸਰਦੀਆਂ ਵਿੱਚ ਮੌਸਮ ਜੋ ਹੈ ਤਾਪਮਾਨ ਮਨਫੀ ਵਿੱਚ ਵੀ ਰਿਕਾਰਡ ਦਰਜ ਕੀਤਾ ਜਾਂਦਾ ਹੈ